ਮੇਰੇ ਕਿਰਦਾਰਾਂ ਦਾ ਵਿਕਾਸ ਮੇਰੇ ਜੀਵਨ ਦਾ ਜਿਹੜਾ ਅਨੁਭਵ ਰਿਹਾ ਜਿਹੜਾ ਐਕਸਪੀਰੀਅਸ ਰਿਹਾ ਕਿਉਂਕਿ ਮੈਂ ਗ੍ਰੈਜੂਏਸ਼ਨ 'ਚ ਬਾਹਰ ਚਲਾ ਗਿਆ ਸੀ ਜਦੋਂ ਮੈਂ ਬਾਰ੍ਹਵੀਂ ਕੀਤੀ ਸੀ ਤਾਂ ਮੈਂ ਦੁਨੀਆ ਦੇਖੀ ਹੀ ਉਹਦੇ ਮਗਰੋਂ ਮੈਂ ਟਰੈਵਲ ਕੀਤਾ ਐਕਸਪਲੋਰ ਕੀਤਾ ਪੜ੍ਹਿਆ ਲਿਖਿਆ ਜਾਣਿਆ ਅਤੇ ਆਲੇ ਦੁਆਲੇ ਵੀ ਮੈਂ ਚੀਜ਼ਾਂ ਨੂੰ ਨੋਟਿਸ ਕਰਨ ਦੀ ਗੌਰ ਕਰਨ ਦੀ ਕੋਸ਼ਿਸ਼ ਕਰਦਾ ਤਾਂ ਮੇਰਾ ਖਿਆਲ ਹੈ ਵੀ ਮੇਰੇ ਕਿਰਦਾਰਾਂ ਦਾ ਜਿਹੜਾ ਵਿਕਾਸ ਹੈ ਉਹ ਜਾਣਨ ਸਮਝਣ ਪੜ੍ਹਨ ਅਤੇ ਐਕਸਪੀਰੀਅਸ ਕਰਨ ਅਤੇ ਉਹਦੇ ਮਗਰੋਂ ਸੋਚਣ 'ਤੇ ਉਹ ਤਬੀਅਤ ਨਾਲ ਵਿਕਾਸ ਹੋਇਆ ਉਹਦਾ ਉਹਨਾਂ ਦਾ ਕਿਰਦਾਰਾਂ ਦਾ ਜੇ ਹੈ ਸੱਚ ਆਪਾਂ ਕੋਈ ਪ੍ਰਕਿਰਿਆ ਦੀ ਗੱਲ ਕਰੀਏ ਵੀ ਇਹੋ ਜਿਹਾ ਕੋਈ ਪ੍ਰੋਸੈਸ ਹੁੰਦਾ ਕੋਈ ਮੈਥਡ ਹੁੰਦਾ ਕਿਰਦਾਰ ਡਿਵੈਲਪ ਕਰਨ ਦਾ ਤਾਂ ਮੈਂ ਇਹ ਸੱਚ ਪਰਸਨਲੀ ਮੈਂ ਇਹੋ ਜਿਹਾ ਕ ਮੇਰੇ ਕੋਲ ਇਹੋ ਜਿਹੀ ਕੋਈ ਪ੍ਰਕਿਰਿਆ ਨਹੀਂ ਜਿਹੜਾ ਅਨਕੋਨਸ਼ੀਅਸ਼ਲੀ ਮੈਂ ਜਾਣਦਾ ਹੋਵਾਂ ਜਿਹੜਾ ਮੈਂ ਆਪਣੇ ਜਾਖਰ ਗਰੁੱਪ ਤੋਂ ਜ ਤੋਂ ਜਾਣਦਾ ਹੋਵਾਂ ਕਿ ਇਹੀ ਪ੍ਰਕਿਰਿਆ ਨੇ ਅਤੇ ਮੇਰੇ ਕੋਲ ਇਹੋ ਜਿਹੀ ਕੁਛ ਖਾਸ ਪ੍ਰਕਿਰਿਆ ਨਹੀਂ ਮੇਰੇ ਕੋਲ ਇਹੋ ਜਿਹਾ ਕੁਛ ਖਾਸ ਪ੍ਰਕਿਰਿਆ ਨਹੀਂ ਪਰ ਜਦੋਂ ਮੈਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਜਾਂ ਇੱਕ ਬੰਦੇ ਨੂੰ ਜਾਣਨ ਦੀ ਉਹਨੂੰ ਸਮਝਣ ਦੀ ਜਦੋਂ ਆਪਾਂ ਕਿਸੇ ਨੂੰ ਪਹਿਲੀ ਵਾਰ ਮਿਲਦੇ ਹਾਂ ਤਾਂ ਮੇਰੇ ਕਿਰਦਾਰਾਂ ਦਾ ਵਿਕਾਸ ਉਹ ਹੁੰਦਾ ਅਤੇ ਜਿਹੜੀ ਮੇਰੀ ਕਿਰਦਾਰਾਂ ਦੀ ਬਣਾਵਟ ਹੈ ਜਾਂ ਜਿਵੇਂ ਮੇਰੇ ਕਿਰਦਾਰਾਂ ਦਾ ਜਿਹੜਾ ਚਰਿੱਤਰ ਹੈ ਜਾਂ ਜੋ ਕਿਸ ਤਰੀਕੇ ਨਾਲ ਵਰਤਾਵ ਕਰਦੇ ਵਰਤੇਵਾਂ ਉਹਨਾਂ ਦਾ ਕੀ ਹੈ ਅਤੇ ਜੇ ਆਪਾਂ ਉਹ ਸਮਾਜ ਨੂੰ ਦੇਖੀਏ ਆਪਣੇ ਆਸੇ ਪਾਸੇ ਆਲੇ ਦੁਆਲੇ ਤਾਂ ਲੋਕ ਕਿਵੇਂ ਕਰਦੇ ਆ ਜਿਵੇਂ ਨੈਚੁਰਲ ਜਿਹਨੂੰ ਸਪੋਂਟੀਨਸ ਆਪਾਂ ਕਹਿੰਦੇ ਹਾਂ ਔਰਗੈਨਿਕਲੀ ਅਤੇ ਮੇਰੇ ਕਿਰਦਾਰਾਂ ਦਾ ਜਿਹੜਾ ਵਿਕਾਸ ਆ ਉਹ ਬੜਾ ਔਰਗੈਨਿਕ ਹੈ ਨਹੀਂ ਜੇ ਅਪਮਾਨਜਨਕ ਸ਼ਬਦਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਮੈਂ ਸੋਚ ਕੇ ਵਿਚਾਰ ਕੇ ਇਹੋ ਜਿਹਾ ਕੁਛ ਕੀ ਸਾਨੂੰ ਡੈਰੋਗੇਟਰੀ ਜਿਹੜਾ ਅਪਮਾਨ ਕਰਨ ਵਾਸਤੇ ਇਹੋ ਜਿਹੇ ਕੁਛ ਸ਼ਬਦ ਜਾਂ ਕਿਰਦਾਰ ਦਾ ਵਰਤੋਂ ਤਾਂ ਨਹੀਂ ਕੀਤੀ ਪਰ ਜਿਹੜਾ ਸੱਸੀ ਨੋ ਨੂੰ ਲਿਖਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ